ਪੰਜਾਬ ਦੇ ਵਿੱਚ ਜਿਹੜਾ ਕਾਰੋਬਾਰੀ ਹੈ ਉਹ ਬਹੁਤ ਸਾਰੀ ਸਰਵਿਸਜ਼ ਦਿੰਦਾ ਹੈ ਅਗਰ ਆਪਾਂ ਇੱਥੋਂ ਐਂਟਰ ਕਰਜੀਏ ਦਿੱਲੀ ਵਾਲੇ ਸਾਈਡ ਤੋਂ ਆਉਂਦੇ ਹੋਏ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਆਉਂਦਾ ਉਹ ਲੋਹ ਸਿਟੀ ਆਉਂਦਾ ਲੋਹਾ ਸਿਟੀ ਜਿਹਨੂੰ ਮੰਡੀ ਗੋਬਿੰਦਗੜ੍ਹ ਦੇ ਨਾਮ 'ਤੇ ਜਾਣਿਆ ਜਾਂਦਾ ਉਹ 'ਚ ਸਾਰਾ ਸਾਰਾ ਲੋਹੇ ਦਾ ਜਿੰਨਾ ਵੀ ਵੱਡਾ ਕਾਰੋਬਾਰ ਹੈ ਸਾਰਾ ਇੱਥੇ ਮੰਡੀ ਗੋਬਿੰਦਗੜ੍ਹ ਹੀ ਹੁੰਦਾ ਸਰਹੰਦ ਅਤੇ ਮੰਡੀ ਗੋਬਿੰਦਗੜ੍ਹ ਇਹ 'ਚ ਬਹੁਤ ਸਾਰੀ ਇੰਡਸਟਰੀ ਲੱਗੀ ਹੈ ਫਰਮਸਿਸ ਲੱਗੀਆਂ ਹੋਈਆਂ ਜਿੱਥੇ ਲੋਹਾ ਗਲਾਇਆ ਜਾਂਦਾ ਘਾਲਿਆਂ ਜਾਂਦਾ ਅਤੇ ਇਹਨੂੰ ਅਲੱਗ ਅਲੱਗ ਬਿਲੇਟਸ ਬਲੂਮ ਦੀ ਸ਼ੇਪ ਦੇ ਵਿੱਚ ਤਿਆਰ ਕਰਕੇ ਅੱਗੇ ਭੇਜਿਆ ਜਾਂਦਾ ਇੱਥੇ ਜਿੰਨਾ ਵੀ ਬਾਹਰ ਤੋਂ ਲੋਹਾ ਆਉਂਦਾ ਜਿਹੜਾ ਜਿਹੜਾ ਆਪਾਂ ਜਿਹਨੂੰ ਕਈ ਵਾਰ ਲੋਹਾ ਸੈਕਿੰਡ ਹੈਂਡ ਲੋਹਾ ਵੀ ਕਹਿ ਦਿੰਦੇ ਹਾਂ ਉਹ ਜਿਹੜਾ ਆਉਂਦਾ ਰਾਹ ਮਟੀਰੀਅਲ ਆਉਂਦਾ ਉੱਥੇ ਸਾਰਾ ਇੱਥੇ ਗਲਾ ਕੇ ਉਹਨੂੰ ਅਲੱਗ ਅਲੱਗ ਫੋਰਮ 'ਚ ਕੀਤਾ ਜਾਂਦਾ ਉਹਦੇ ਅਤੇ ਬਹੁਤ ਜ਼ਿਆਦਾ ਇੰਪਲੋਈ ਜਿਹੜਾ ਰੱਖਿਆ ਜਾਂਦਾ ਅਤੇ ਨੋਰਮਲੀ ਜਿਹੜਾ ਇੱਕ ਵਾਰ ਜਿਹੜਾ ਫਰਮਸਿਸ ਦੇ ਵਿੱਚ ਲੱਗ ਜਾਵੇ ਤਾਂ ਉਹ ਬੰਦਾ ਟਰੇਨਡ ਹੋ ਜਾਂਦਾ ਅਤੇ ਉਹ ਪੱਕੀ ਨੌਕਰੀ ਵਾਂਗੂ ਕੰਮ ਹੋ ਜਾਂਦਾ ਉਹਦਾ ਪੱਕਾ ਹੀ ਰਹਿ ਜਾਂਦਾ ਉਸ ਤੋਂ ਅੱਗੇ ਅਗਰ ਆਪਾਂ ਚਲੇ ਜਾਈਏ ਫਿਰ ਲੁ ਲੁਧਿਆਣਾ ਅੱਗੇ ਸ਼ਹਿਰ ਆ ਜਾਂਦਾ ਲੁਧਿਆਣਾ ਆਪਾਂ ਨੂੰ ਪਤਾ ਹੀ ਸਾਰਾ ਹੋਜਰੀ ਦਾ ਬੜਾ ਮਸ਼ਹੂਰ ਹੈ ਸਾਈਕਲ ਇੰਡਸਟਰੀ ਉੱਥੇ ਹੈ ਸਾਈਕਲਾਂ ਦੇ ਪਾਰਟਸ ਉੱਥੇ ਬਣਦੇ ਆ ਇਹ ਸਾਰੀ ਇੰਪਲੋਬਿਲਟੀ ਉੱਥੇ ਜਨਰੇਟ ਹੋ ਰਹੀ ਹੈ ਸਾਈਕਲਾਂ ਦੇ ਪਾਰਟਸ ਸਾਈਕਲ ਅਸੈਂਬਲ ਕਰਨੇ ਨਾਲੇ ਨਾਲ ਹੋਜਰੀ ਦਾ ਬਹੁਤ ਸਾਰਾ ਸਮਾਨ ਜਿਹੜਾ ਹੈ ਸਰਦੀਆਂ ਦੇ ਕੱਪੜੇ ਗਰਮੀਆਂ ਦੇ ਕੱਪੜੇ ਤਿਆਰ ਹੁੰਦੇ ਹੈ ਫਿਰ ਉਸ ਤੋਂ ਅੱਗੇ ਨਾਲ ਹੀ ਅੱਗੇ ਆਪਾਂ ਚਲੇ ਜਾਈਏ ਫਗਵਾੜਾ ਬੜਾ ਮਸ਼ਹੂਰ ਹੈ ਜੇ ਸੀ ਟੀ ਫਗਵਾੜਾ ਨਾਲ ਹੀ ਉੱਥੇ ਮਿੱਲਾਂ ਹੈ ਜਿਹੜੀਆਂ ਕੱਪੜੇ ਦਾ ਕੰਮ ਬਹੁਤ ਸਾਰਾ ਫਗਵਾੜਾ ਹੁੰਦਾ ਬਣਦੀ ਆ ਅਤੇ ਉਸ ਤੋਂ ਅੱਗੇ ਫਿਰ ਆਪਾਂ ਚਲੇ ਜਾਈਏ ਜਲੰਧਰ ਆ ਜਾਂਦਾ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਫਗਵਾੜਾ ਤੋਂ ਜਦੋਂ ਆਪਾਂ ਚੱਲੀਏ ਤਾਂ ਜਲੰਧਰ ਵਾਲੇ ਰਸਤੇ 'ਚ ਬਹੁਤ ਸਾਰੀਆਂ ਫੈਕਟਰੀਆਂ ਆਉਂਦੀਆਂ ਜਿਹਦੇ ਵਿੱਚ ਸਪੋਰਟਸ ਦਾ ਸਮਾਨ ਬਣਦਾ ਹੈ ਫਾਈਨ ਸਵਿਚਜਿਸ ਜਿਹੜੇ ਇਲੈਕਟਰੀਕਲ ਜਿਹੜੇ ਅਪਲਾਈਸੈਂਸ ਹੈ ਉਹ ਬਹੁਤ ਜ਼ਿਆਦਾ ਉੱਥੇ ਬਣਦੇ ਆ ਫਿਰ ਉਸ ਤੋਂ ਅੱਗੇ ਆਪਾਂ ਅੰਮ੍ਰਿਤਸਰ ਚਲੇ ਜਾਈਏ ਇੱਥੇ ਵੀ ਬਹੁਤ ਸਾਰਾ ਜਿਹੜਾ ਸਮਾਨ ਜਿਹੜਾ ਹੈ ਅਲੱਗ ਅਲੱਗ ਚਮੜੇ ਦਾ ਬਹੁਤ ਸਾਰਾ ਸਮਾਨ ਅੰਮ੍ਰਿਤਸਰ ਬਣਦਾ ਭਾਵ ਕਹਿਣ ਦਾ ਇਹ ਹੈ ਵੀ ਸਾਰੀ ਜਿੰਨੀ ਵੀ ਅਲੱਗ ਅਲੱਗ ਇੰਡਸਟਰੀ ਹੈ ਇਹ ਸਾਰੀ ਇੰਪਲੋਏਬਿਲਟੀ ਜਨਰੇਟ ਕਰ ਰਹੀ ਹੈ ਜਿਹੜੇ ਜਿਹੜੇ ਇੰਪਲੋਏ ਨਿਕਲਦੇ ਆ ਜਿਹੜੇ ਸਿੱਖ ਸਿੱਖ ਕੇ ਬੱਚੇ ਇੱਥੋਂ ਨਿਕਲਦੇ ਆ ਉਹ ਸਾਰੇ ਇੱਧਰ ਜਾਂਦੇ ਆ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਖੇਤੀਬਾੜੀ ਦਾ ਹੈ ਖੇਤੀਬਾੜੀ ਵਾਸਤੇ ਇੱਥੇ ਜਿਵੇਂ ਬਹੁਤ ਸਾਰੇ ਜਿੰਨੇ ਵੀ ਬਾਹਰ ਤੋਂ ਜਿਹੜੇ ਲੋਕ ਆਉਂਦੇ ਆ ਖੇਤੀਬਾੜੀ ਵੱਲ ਬੜਾ ਇੰਟਰਸਟ ਸ਼ੋ ਕਰਦੇ ਹਾਂ ਅਤੇ ਜਿੰਨੀ ਲੇਬਰ ਹੈ ਬਹੁਤ ਸਾਰੀ ਲੇਬਰ ਜਿਹੜੀ ਹੈ ਉਹ ਖੇਤੀਬਾੜੀ 'ਚ ਵੀ ਇਸਤੇਮਾਲ ਹੁੰਦੀ ਹੈ ਡੇਅਰੀ ਹਾਓ ਡੇਅਰੀ ਉਦਯੋਗ ਬਹੁਤ ਇੱਥੇ ਵਧੀਆ ਚੱਲ ਰਿਹਾ ਹੈਗਾ ਉਹਦੇ 'ਚ ਵੀ ਨੌਕਰੀਆਂ ਬਹੁਤ ਸਾਰੀਆਂ ਨਿਕਲਦੀਆਂ